ਨਵ ਜੰਮੇ ਬੱਚੇ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਪਹਿਲਾਂ ਸਭ ਨੂੰ ਵਾਤਾਵਰਨ ਸਾਫ਼ ਅਤੇ ਸੁਥਰਾ ਰੱਖਣਾ ਚਾਹੀਦਾ ਹੈ ਉਸ ਤੋਂ ਬਾਅਦ ਆਵਾਜਾਈ ਤੋਂ ਦੂਰ ਰੱਖਣਾ ਚਾਹੀਦਾ ਹੈ ਕਿਉਂਕਿ ਗੱਡੀਆਂ ਮੋਟਰਸਾਈਕਲਾਂ ਦੀ ਆਵਾਜ਼ ਨਵ ਜੰਮ ਨਵ ਜੰਮੇ ਬੱਚੇ ਨੂੰ ਤੰਗ ਕਰ ਸਕਦੀ ਹੈ ਅਤੇ ਨਾਲ ਹੀ ਨਾਲ ਉਸ ਨੂੰ ਨੋਰਮਲ ਟੈਂਪਰੇਚਰ ਵਿੱਚ ਰੱਖਣਾ ਚਾਹੀਦਾ ਹੈ ਜਿੱਥੇ ਕਿ ਜ਼ਿਆਦਾ ਗਰਮੀ ਜਾਂ ਜ਼ਿਆਦਾ ਠੰਡ ਨਾ ਹੋਵੇ ਇਸ ਇਸ ਤਰ੍ਹਾਂ ਅਸੀਂ ਨ ਨਵ ਜੰਮੇ ਬੱਚੇ ਨੂੰ ਬਿਮਾਰੀਆਂ ਤੋਂ ਬਚਾਅ ਸਕਦੇ ਹਾਂ ਇਸ ਤੋਂ ਇਲਾਵਾ ਸਾਨੂੰ ਉਸ ਦੀ